ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਕਿ ਪੰਜਾਬ ਬਿਤ ਪੰਜਾਬ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਯੂਨੀਵਰਸਿਟੀ ਅਤੇ ਕੋਲਜ ਹਨ ਜਿਹੜੇ ਕਿ ਬਹੁਤ ਹੀ ਉੱਚ ਸਿੱਖਿਆ ਪ੍ਰਦਾਨ ਕਰਦੇ ਹਨ ਉਹਨਾਂ ਦੇ ਵਿੱਚੋਂ ਇੱਕ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੀ ਹੈ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਹੈ ਇਹ ਸਾਰੀਆਂ ਯੂਨੀਵਰਸਿਟੀ ਬਹੁਤ ਹੀ ਉੱਚ ਕੋਟੀ ਦੇ ਕੋਰਸਿਸ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਵਿਦਿਆਰਥੀ ਆਪਣੇ ਅੱਗੇ ਦੇ ਫਿਊਚਰ ਨੂੰ ਵਧੀਆ ਬਣਾ ਸਕਦੇ ਹਨ ਜੇ ਉਹ ਇਹਨਾਂ ਦੇ ਇਹਨਾਂ ਦੁਆਰਾ ਜਿਹੜੇ ਵੀ ਕੋਰਸ ਕੀਤ ਕਰਵਾਏ ਜਾਂਦੇ ਹਨ ਉਹਨਾਂ ਨੂੰ ਕਰ ਲੈਣ ਤਾਂ ਉਹ ਅੱਗੇ ਜਾ ਕੇ ਆਪਣਾ ਫਿਊਚਰ ਆਪਣਾ ਭਵਿੱਖ ਵਧੀਆ ਤਰੀਕੇ ਦੇ ਨਾਲ ਬਣਾ ਸਕਦੇ ਹਨ ਜੇ ਅਸੀਂ ਇਹਨਾਂ ਦੇ ਕੋਰਸਾਂ ਬਾਰੇ ਗੱਲ ਕਰੀਏ ਤਾਂ ਇਹਨਾਂ ਵਿੱਚ ਬਹੁਤ ਸਾਰੇ ਕੋਰਸਿਸ ਕਰਵਾਏ ਜਾਂਦੇ ਹਨ ਜਿਹੜੇ ਕਿ ਕੋਰਸਿਸ ਕੁਝ ਕੋਰਸਿਸ ਉਹਨਾਂ ਦੇ ਵਿੱਚੋਂ ਆਈ ਟੀ ਦੇ ਨਾਲ ਰਿਲੇਟਡ ਹੁੰਦੇ ਹਨ ਕੁਝ ਕੋਰਸਿਸ ਉਹਨਾਂ ਦੇ ਵਿੱਚੋਂ ਕਮਰਸ ਦੇ ਨਾਲ ਰਿਲੇਟਿਡ ਹੁੰਦੇ ਹਨ ਕੁਝ ਕੋਰਸ ਉਹਨਾਂ ਦੇ ਵਿੱਚੋਂ ਐਗਰੀਕਲਚਰ ਦੇ ਨਾਲ ਰਿਲੇਟਡ ਹੁੰਦੇ ਹਨ ਸਾਰੇ ਯੂਨੀਵਰਸਿਟੀਜ਼ ਦੀ ਆਪਣੇ ਆਪਣੇ ਕੋਰਸਿਸ ਹੁੰਦੇ ਹਨ ਅਤੇ ਉਹਨਾਂ ਉਹ ਆਪਣੇ ਆਪਣੇ ਰੂਲ ਰੈਗੂਲੇਸ਼ਨਜ਼ ਦੇ ਅਕੋਡਿੰਗ ਉਹਨਾਂ ਨੂੰ ਚਲਾਉਂਦੇ ਹਨ ਜੇ ਅਸੀਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਹ ਆਈ ਟੀ ਦੇ ਸਾਰੇ ਕੋਰਸਿਸ ਕਰਵਾਉਂਦੇ ਹਨ ਅਤੇ ਉਹਨਾਂ ਦੇ ਵਿੱਚ ਬਹੁਤ ਹੀ ਵਧੀਆ ਸਬਜੈਕਟ ਸਾਨੂੰ ਪੜ੍ਹਾਏ ਜਾਂਦੇ ਹਨ ਅਤੇ ਵਧੀਆ ਤਰੀਕੇ ਦੇ ਨਾਲ ਕਰਾਏ ਜਾਂਦੇ ਹਨ ਜਿਹੜਾ ਕਿ ਸਾਨੂੰ ਅੱਗੇ ਜਾ ਕੇ ਬਹੁਤ ਹੀ ਸਾਡੇ ਕੰਮ ਆਉਂਦੇ ਹਨ ਉਹਨਾਂ ਨੂੰ ਪੜ੍ਹ ਕੇ ਅਸੀਂ ਅੱਗੇ ਜਾ ਕੇ ਆਪਣੇ ਫਿਊਚਰ ਦੇ ਵਿੱਚ ਵਧੀਆ ਜੋਬ ਕਰ ਸਕਦੇ ਹਨ ਅਤੇ ਵਧੀਆ ਸੈਲਰੀ ਲੈ ਸਕਦੇ ਹਨ ਜਿਸ ਨਾਲ ਅਸੀਂ ਆਪਣਾ ਅਤੇ ਆਪਣੇ ਘਰ ਦਾ ਵੀ ਵਧੀਆ ਤਰੀਕੇ ਦੇ ਨਾਲ ਸਪੋਟ ਕਰ ਸਕਦੇ ਹਾਂ